ਸਤਿ ਸ਼੍ਰੀ ਅਕਾਲ ਜੀ ਮੈਂ ਤਨਵੀਰ ਸਿੰਘ ਕੀ ਮੇਰੀ ਗੱਲ ਪਹਿਲਵਾਨ ਢਾਬੇ 'ਤੇ ਹੋ ਰਹੀ ਹੈ ਮੈਂ ਪੰਦਰ੍ਹਾਂ ਮਿੰਟ ਪਹਿਲਾਂ ਔਡਰ ਕੀਤਾ ਸੀ ਸ਼ਾਹੀ ਪਨੀਰ ਅਤੇ ਦਾਲ ਮੱਖਣੀ ਇ ਇਸ ਵਿੱਚ ਮੇਰੀਆਂ ਥੋੜ੍ਹੀਆਂ ਹਿਦਾਇਤਾਂ ਸੀ ਜਿਵੇਂ ਕਿ ਤੁਹਾਡਾ ਸਪੈਸ਼ਲ ਅਚਾਰ ਆਪਣੇ ਕਿਸੇ ਬੜੇ ਕੰਟੇਨਰ 'ਚ ਪਾ ਦਿਓ ਅਤੇ ਕੁਛ ਕੁ ਭਾਂਡੇ ਨਾਲ ਭੇਜ ਦਿਓ ਕਿਉਂਕੀ ਇਸ ਟਾਈਮ ਅਸੀਂ ਬਾਹਰ ਬੈਠੇ ਹਾਂ ਅਤੇ ਸਾਡੇ ਕੋਲ ਖਾਣ ਪੀਣ ਲਈ ਕੋਈ ਵੀ ਬਰਤਨ ਨਹੀਂ ਹੈ ਅਤੇ ਦੂਜੀ ਹਿਦਾਇਤ ਮੇਰੀ ਇਹ ਸੀ ਕਿ ਦਾਲ ਮੱਖਣੀ ਵਿੱਚ ਥੋੜ੍ਹੀ ਮਿਰਚ ਘੱਟ ਰੱਖੀ ਜਾਵੇ ਕਿਉਂਕੀ ਮੈਨੂੰ ਜ਼ਿਆਦਾ ਤੇਜ਼ ਮਿਰਚ ਪਸੰਦ ਨਹੀਂ ਹੈ ਅਤੇ ਸ਼ਾਹੀ ਪਨੀਰ ਵਿੱਚ ਪਨੀਰ ਥੋੜ੍ਹਾ ਜਿਹਾ ਜ਼ਿਆਦਾ ਪਾਵੇ ਅਤੇ ਗ੍ਰੇਵੀ ਘੱਟ ਹੋਣੀ ਚਾਹੀਦੀ ਹੈ ਮੈਂ ਇਸ ਮੈਂ ਤੁਹਾਨੂੰ ਫ਼ੋਨ ਇਸ ਲਈ ਕੀਤਾ ਹੈ ਕਿਉਂਕੀ ਮੈਨੂੰ ਲੱਗਿਆ ਕਿ ਤੁਸੀਂ ਸ਼ਾਇਦ ਇਹ ਹਿਦਾਇਤਾਂ ਨਾ ਪੜ੍ਹੋ ਅਤੇ ਅਤੇ ਜਿਵੇਂ ਵੀ ਤੁਹਾਨੂੰ ਪੈਸੇ ਦੀ ਟਰਾਂਸਫਰ ਕਰਨਾ ਹੋਵੇ ਮੈਨੂੰ ਦੱਸ ਦਿਓ ਜੇ ਤੁਸੀਂ ਪੈਸੇ ਗੂਗਲ ਪੇਅ ਰਾਹੀਂ ਮੰਗਵਾਉਣੇ ਹੈ ਤਾਂ ਆਪਣਾ ਬਾਰਕੋਡ ਡਿਲੀਵਰੀ ਬੋਆਏ ਕੋਲ ਭੇਜ ਦਿਓ